ਦੇਖੋ ਜੀ ਪੰਜਾਬ 'ਚ ਚੋਟੀ ਦੇ ਹਸਪਤਾਲਾਂ ਵਿੱਚ ਆਉਂਦੇ ਆ ਜਿਵੇਂ ਆਪਣਾ ਪੰਜਾਬ ਕੈਂਸਰ ਕੇਅਰ ਅਤੇ ਮਲਟੀ ਸਪੈਸ਼ਲਟੀ ਹੋਸਪੀਟਲ ਬਠਿੰਡੇ ਵਾਲਾ ਹੋ ਗਿਆ ਇੱਥੇ ਆਪਣਾ ਬਈ ਕੈਂਸਰ ਦਾ ਟ੍ਰੀਟਮੈਂਟ ਚੱਲਿਆ ਅਤੇ ਬਾਈ ਇੱਕ ਆਪਣਾ ਹੋ ਗਿਆ ਹਾਲੇ ਨਵਾਂ ਨਵਾਂ ਖੁੱਲ੍ਹਿਆ ਹੈ ਏਮਸ ਹੋ ਗਿਆ ਏਮਸ ਤਾਂ ਏਮਸ 'ਚ ਵੀ ਕਾਫੀ ਵਧੀਆ ਫੈਸਲਿਟੀਜ਼ ਨੇ ਅਤੇ ਜਿਵੇਂ ਆਪਣੇ ਡਾਕਟਰ ਵੀ ਚੰਗੇ ਹੈਗੇ ਆ ਅਤੇ ਪਰ ਲਾਈਨਾਂ ਬਾਲੀ ਲੰਬੀਆਂ ਲੱਗਦੀਆਂ ਹੈ ਯਾਰ ਅਤੇ ਤੀਜਾ ਆਪਣਾ ਅਦੇਸ਼ ਹੋਸਪਿਟਲ ਹੋ ਗਿਆ ਬਠਿੰਡੇ ਦਾ ਅਤੇ ਇੱਕ ਆਪਣਾ ਡੀ ਐੱਮ ਸੀ ਵੀ ਹੈਗਾ ਦਨਆਨ ਦਿਆਨੰਦ ਮੈਡੀਕਲ ਕੋਲਜ ਅਤੇ ਹਸਪਤਾਲ ਲੁਧਿਆਣਾ 'ਚ ਉਹ ਵੀ ਬੜਾ ਨਾਮੀ ਹਸਪਤਾਲ ਹੈਗਾ ਅਤੇ ਤੀਜਾ ਆਪਣਾ ਇਹ ਮੈਕਸ ਸਪੋਸ ਸਪੈਸ਼ਲਟੀ ਹਸਪਤਾਲ ਹੋ ਗਿਆ ਇਹ ਮੈਕਸ ਤਾਂ ਹਾਲੇ ਬਠਿੰਡੇ ਵੀ ਹੈਗਾ ਮੋਹਾਲੀ ਵੀ ਹੈਗਾ ਤੇ ਇੱਕ ਆਪਣਾ ਆਈ ਵੀ ਹੋਸਪਿਟਲ ਇਹ ਬਠਿੰਡੇ ਵੀ ਹੈਗਾ ਅਤੇ ਮੋਹਾਲੀ ਵੀ ਹੈਗਾ ਅਤੇ ਆਸੇ ਪਾਸੇ ਆਪਣੇ ਸਿਰੇ ਦਾ ਹਸਪਤਾਲ ਹੈਗਾ ਹਸਪਤਾਲ ਵਾਲੀ ਫੈਸਿਲਿਟੀ ਕਾਫੀ ਚੰਗੀਆਂ ਨੇ ਪੰਜਾਬ ਵਿੱਚ

ਮੈਂ ਹਾਲੇ ਗਿਆ ਸੀਗਾ ਇੱਕ ਵਾਰੀ ਬਠਿੰਡੇ ਏਮਜ਼ 'ਚ ਤਾਂ ਉੱਥੇ ਵੀ ਸਟਾਫ ਡਾਕਟਰ ਸਾਹਿਬ ਨੇ ਕਾਫੀ ਚੰਗੀ ਤਰ੍ਹਾਂ ਗੱਲ ਕੀਤੀ ਮੇਰੀ ਸਾਰੀ ਗੱਲ ਸੁਣੀ ਤਾਂ ਫਿਰ ਜਾ ਕੇ ਉਹਨੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਬਈ ਇੱਦਾਂ ਇੱਦਾਂ ਕਰਕੇ ਤੁਸੀਂ ਬਿਮਾਰੀ ਦਾ ਆਪਾਂ ਜੋ ਹੈ ਦਵਾਈ ਦਵੁਈ ਲੈਣੀ ਹੈਗੀ ਤਾਂ ਇਹ ਟੈਸਟ ਕਰਾਉਣੇ ਆ ਤਾਂ ਇਹ ਸਭ ਦਵਾਈ ਦਵੁਈਆਂ ਲੈਣੀ ਹੈ ਅਤੇ ਚੰਗੇ ਕਾਫੀ ਇਹ ਸਿਰੇ ਦੇ ਹਸਪਤਾਲ ਹੈਗੇ ਆ ਜਿਹੜੇ ਮੈਂ ਦੱਸੇ ਆ ਆਪਣੇ ਪੰਜਾਬ 'ਚ